ਸਿਹਤ ਅਤੇ ਸੰਭਾਲ ਦਾ ਸੁਧਾਰ ਕਿ ਹਰ ਪਿੰਡ ਅਤੇ ਕਸਬੇ ਵਿੱਚ ਪ੍ਰਾਇਮਰੀ ਹੈਲਥ ਕੇਅਰ ਦੀ ਸਥਾਪਨਾ ਸੌਖੇ ਪਹੁੰਚ ਵਾਲੇ ਹਸਪਤਾਲਾਂ ਦਾ ਵਿਕਾਸ ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸੇਵਾਵਾਂ ਚੰਗੀ ਤਰ੍ਹਾਂ ਟਰੇਨਿੰਗ ਵਾਲਾ ਸਟਾਫ ਐਮਰਜੰਸੀ ਸੇਵਾਵਾਂ ਜਿਵੇਂ ਕਿ ਐਂਬੂਲੈਂਸਾ ਦੀ ਅਤੇ ਸਿੱਖਿਆ ਵਿੱਚ ਸੁਧਾਰ ਹੋਵੇ ਸਕੂਲ ਅਤੇ ਕਾਲਜਾਂ ਦੀ ਸਥਾਪਨਾਵਾਂ ਸਿੱਖਿਆ ਅਤੇ ਸਿੱਖਿਆ ਨੂੰ ਸਮਰੱਥਾ ਬਣਾਉਣਾ ਅਧਿਆਪਕਾਂ ਨੂੰ ਅਧਿਆਪਕਾਂ ਦੀ ਘਾਟ ਦੂਰ ਕਰਨਾ ਕਿ ਉਹਨਾਂ ਨੂੰ ਬੱਚਿਆਂ ਨੂੰ ਪੜਾਉਣ ਵਿੱਚ ਕੋਈ ਤਕਲੀਫ ਜਾਂ ਦੁੱਖ ਨਾ ਆਏ ਵਿਦਿਆਰਥੀਆਂ ਲਈ ਸਕਾ ਸਕਾਲਰਸ਼ਿਪ ਦੀ ਪ੍ਰੇਰਨਾ ਜਿੰਨਾਂ ਕਰਕੇ ਜਿਹੜੇ ਵਿਦਿਆਰਥੀ ਘਰੋਂ ਕਮਜ਼ੋਰ ਹਨ ਜਾ ਅਮੀਰ ਨਾ ਨਹੀਂ ਹਨ ਅਤੇ ਗਰੀਬੀ ਦੀ ਸਥਿਤੀ ਵਿੱਚ ਹਨ ਉਹ ਬਿਨ੍ਹਾਂ ਕਿਸੇ ਸਮੱਸਿਆ ਤੋਂ ਪੜ੍ਹ ਸਕਣ ਅਤੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰ ਸਕਣ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਜਿਵੇਂ ਪਾਣੀ ਸਾਫ਼ ਸੁਥਰਾ ਪਾਣੀ ਬਿਜਲੀ ਅਤੇ ਸੜਕਾਂ ਰੋਜ਼ਗਾਰ ਦੇ ਮੌਕੇ